ਹਾਂਜੀ ਮੈਂ ਤਿਉਹਾਰਾਂ ਧਾਰਮਿਕ ਮੌਕਿਆਂ 'ਤੇ ਦੇਵਤਿਆਂ ਦੀ ਮੂਰਤੀਆਂ ਬਣਾਈਆਂ ਹਨ ਜਿਵੇਂ ਕਿ ਗਣੇਸ਼ ਚਤੁਰਤੀ 'ਤੇ ਮੈਂ ਗਣੇਸ਼ ਜੀ ਦੀ ਮੂਰਤੀ ਖੋਏ ਦੀ ਬਣਾਈ ਖੋਏ ਦੀ ਮੂਰਤੀ ਜਿਵੇਂ ਕਿ ਸਾਡਾ ਸਵੀਟਸ ਦਾ ਕੰਮ ਆ ਸਵੀਟਸ ਦਾ ਮਿਠਾਈਆਂ ਦਾ ਕੰਮ ਹੈ ਸਾਡਾ ਅਤੇ ਮੈਂ ਥੋੜ੍ਹਾ ਜਿਹਾ ਖੋਇਆ ਲੈ ਕੇ ਅਤੇ ਅ ਯੂਟੀਊਬ ਤੋਂ ਦੇਖ ਦੇਖ ਕੇ ਗਣੇਸ਼ ਜੀ ਦੀ ਮੂਰਤੀ ਬਣਾਈ ਫਿਰ ਉਹਨਾਂ ਨੂੰ ਥੋੜ੍ਹੀ ਦੇਰ ਵਾਸਤੇ ਮੰਦਰ ਵਿੱਚ ਰੱਖ ਕੇ ਉਹਨਾਂ ਨੂੰ ਭੋਗ ਲਗਾ ਕੇ ਉਹਨਾਂ ਦੀ ਪੂਜਾ ਅਰਚਨਾ ਕਰਕੇ ਉਹ ਮੈਂ ਮੂਰਤੀ ਖੋਏ ਦੀ ਦੁੱਧ ਵਿੱਚ ਘੋਲ ਕੇ ਸਾਰਿਆਂ ਨੂੰ ਉਹ ਦੁੱਧ ਪ੍ਰਸ਼ਾਦ ਦੇ ਰੂਪ ਵਿੱਚ ਵੰਡ ਦਿੱਤਾ ਮੈਨੂੰ ਇਹ ਬਣਾ ਕੇ ਬੜਾ ਸੁੱਖ ਦਾ ਅਨੁਭਵ ਹੋਇਆ ਬੜਾ ਸੁਖਦ ਮਹਿਸੂਸ ਹੋਇਆ ਕਿ ਹਾਂ ਮੇਰੇ ਹੱਥੋਂ ਵੈਸੇ ਮੈਂ ਕਈ ਵਾਰੀ ਦੇਖੀ ਦਾ ਹੈ ਕਿ ਜਿਵੇਂ ਟੀਵੀਆਂ 'ਤੇ ਅ ਜਾਂ ਟੀਵੀਸ ਵਿੱਚ ਜਾਂ ਮੀਡੀਆ ਦੇ ਵਿੱਚ ਵੇਖੀ ਦਾ ਹੈ ਕਿ ਮੂਰਤੀਆਂ ਬਾਜ਼ਾਰਾਂ ਤੋਂ ਲਿਆ ਕੇ ਲੋਕ ਉਹਨਾਂ ਦੀ ਪੂਜਾ ਕਰਦੇ ਨੇ ਪਹਿਲਾਂ ਘਰਾਂ ਵਿੱਚ ਸਥਾਪਿਤ ਕਰਦੇ ਨੇ ਫਿਰ ਉਹਨਾਂ ਦੀ ਕਿੰਨੇ ਦਿਨ ਪੂਜਾ ਕਰਨ ਤੋਂ ਬਾਅਦ ਉਹਨਾਂ ਨੂੰ ਐਦਾਂ ਹੀ ਗੰਦੇ ਪਾਣੀ ਵਿੱਚ ਸੁੱਟ ਆਉਂਦੇ ਨੇ ਜਿਹੜੀ ਕਿ ਮੈਨੂੰ ਸਹੀ ਨਹੀਂ ਲੱਗੇ ਇਸ ਵਾਸਤੇ ਮੈਂ ਖੋਏ ਦੀ ਬਣਾਈ ਥੈਂਕ ਯੂ